ਅਸੀਂ ਆਪਣੇ ਘਰ ਆਏ ਮਹਿਮਾਨਾਂ ਲਈ ਸਰਦੀਆਂ ਵਿੱਚ ਚਾਹ ਅਤੇ ਪਕੌੜੇ ਦਾ ਪ੍ਰਬੰਧ ਕਰਦੇ ਹਾਂ ਔਰ ਸਾਡੇ ਘਰ ਵਿੱਚ ਉਹਨਾਂ ਲਈ ਹੋਰ ਵੀ ਪ੍ਰਕਾਰ ਦੀਆਂ ਚੀਜ਼ਾਂ ਬਣਦੀਆਂ ਹਨ ਜਿਵੇਂ ਕਿ ਸਮੋਸੇ ਬਾਹਰੋਂ ਲੈ ਆਉਂਦੇ ਹਾਂ ਔਰ ਕਦੀ ਕਦੀ ਅਸੀਂ ਆਪਣੇ ਘਰ ਵਿੱਚ ਨੂਡਲਸ ਵੀ ਬਣਾਉਂਦੇ ਹਾਂ ਜੋ ਕਿ ਉਹਨਾਂ ਨਾ ਉਹਨਾਂ ਨੂੰ ਬਹੁਤ ਹੀ ਪਸੰਦ ਆਉਂਦੇ ਹਨ ਅਤੇ ਕਈ ਵਾਰ ਅਸੀਂ ਆਪਣੇ ਮਹਿਮਾਨਾਂ ਲਈ ਬਿਸਕਿਟ ਨਮਕੀਨ ਕੁਰਕੁਰੇ ਚਿਪਸ ਡ੍ਰਾਏ ਫਰੂਟਸ ਇਹ ਵੀ ਬਹੁਤ ਹੀ ਜ਼ਿਆਦਾ ਵਰਤੋਂ ਵਿੱਚ ਲੈ ਕੇ ਆਉਂਦੇ ਹਾਂ ਗਰਮੀਆਂ ਵਿੱਚ ਆਪਾਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਹਿਮਾਨਾਂ ਲਈ ਨਿੰਬੂ ਪਾਣੀ ਜਾਂ ਫਿਰ ਕੋਈ ਕੋਲਡ ਡਰਿੰਕ ਦਾ ਵੀ ਵਰਤੋਂ ਕਰਦੇ ਹਾਂ ਜੋ ਕਿ ਉਹਨਾਂ ਲਈ ਉਹਨਾਂ ਨੂੰ ਠੰਡਕ ਪਹੁੰਚਾਏ ਔਰ ਉਹਨਾਂ ਲਈ ਅਸੀਂ ਹੋਰ ਵੀ ਖਾਣ ਦੀਆਂ ਚੀਜ਼ਾਂ ਜਿੱਦਾਂ ਕਿ ਪੈਕਟ ਪੈਕਟ ਵਾਲੇ ਲੇਜ਼ ਔਰ ਬਾਕੀ ਚੀਜ਼ਾਂ ਜਿੱਦਾਂ ਕਿ ਹੋ ਗਏ ਕੋਈ ਚਾਟ ਵਗੈਰਾ ਉਹਨਾਂ ਲਈ ਬਣਾਈ ਜਾਂਦੀ ਹੈ ਜੋ ਕਿ ਉਹਨਾਂ ਦੇ ਮਨਪਸੰਦ ਹੀ ਹੁੰਦੀ ਹੈ ਔਰ ਸਾਡੇ ਘਰ ਵਿੱਚ ਆਪਣੇ ਮਹਿਮਾਨਾਂ ਨਾਲ਼ ਬਹੁਤ ਹੀ ਪਿਆਰ ਨਾਲ਼ ਪੇਸ਼ ਆਇਆ ਜਾਂਦਾ ਹੈ ਤਾਂ ਕਿ ਉਹ ਖੁਸ਼ੀ ਖੁਸ਼ੀ ਸਾਡੇ ਘਰ ਵਿੱਚ ਆਉਣ ਅਤੇ ਆਪਣਾ ਪੈਰ ਪਾਉਣ ਕਿਉਂਕਿ ਇੱਕ ਮਹਿਮਾਨ ਮਹਿਮਾਨ ਬਹੁਤ ਹੀ ਜ਼ਿਆਦਾ ਰੱਬ ਦੇ ਰੂਪ ਨਾਲ਼ ਹੀ ਮੰਨਿਆ ਜਾਂਦਾ ਹੈ ਸਾਡੇ ਘਰ ਵਿੱਚ ਔਰ ਸਾਡੇ ਪੰਜਾਬੀ ਸੱਭਿਆਚਾਰ ਵਿੱਚ